ਭੰਗੜਾ ਭੰਗੜਾ ਪੰਜਾਬ ਦਾ ਬਹੁਤ ਹੀ ਮਸ਼ਹੂਰ ਲੋਕ ਨਾਚ ਹੈ ਜੋ ਪੰਜਾਬੀਆਂ ਦੀ ਦਿਲ ਦੀ ਧੜਕਣ ਹੈ ਪੰਜਾਬ ਦੇ ਵਿੱਚ ਕੋਈ ਵੀ ਖੁਸ਼ੀ ਦਾ ਸਮਾਂ ਜਸ਼ਨ ਦਾ ਸਮਾਗਮ ਜਾਂ ਕੋਈ ਵਿਆਹ ਦਾ ਸਮਾਗਮ ਹੁੰਦਾ ਹੈ ਤਾਂ ਉਹ ਭੰਗੜੇ ਅਤੇ ਢੋਲ ਦੇ ਡਗੇ ਤੋਂ ਬਿਨਾਂ ਅਧੂਰਾ ਹੈ ਜਦੋਂ ਪ੍ਰੋਗਰਾਮ ਦੇ ਵਿੱਚ ਢੋਲ ਵੱਜਦਾ ਹੈ ਤਾਂ ਹਰੇਕ ਪੰਜਾਬੀ ਦੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈ ਤੇ ਉਸ ਦਾ ਮਤ ਬਦੋ ਬਦੀ ਨੱਚਣ ਨੂੰ ਜੀ ਕਰ ਪੈਂਦਾ ਹੈ ਅਤੇ ਉਹ ਖੁਸ਼ੀ ਵਿੱਚ ਆ ਕੇ ਖੂਬ ਨੱਚਦਾ ਹੈ ਧਮਾਲ ਜੁਗਨੀ ਡਬਲ ਜੁਗਨੀ ਇਹ ਪੰਜਾਬੀਆਂ ਦੇ ਭੰਗੜੇ ਦੇ ਆਮ ਸਟੈਪ ਨੇ ਜੋ ਕਿ ਹਰੇਕ ਪੰਜਾਬੀ ਲਗਭਗ ਹਰੇਕ ਪੰਜਾਬੀ ਜਾਣਦਾ ਜਦੋਂ ਵੀ ਢੋਲ ਦੇ ਡਗਾ ਲੱਗਦਾ ਹੈ ਤਾਂ ਪੰਜਾਬੀਆਂ ਦੇ ਪੈਰ ਆਪਣੇ ਆਪ ਹੀ ਥਿਰਕਣੇ ਸ਼ੁਰੂ ਹੋ ਜਾਂਦੇ ਹਨ ਅਤੇ ਉਹ ਬਹੁਤ ਹੀ ਜੋਸ਼ ਨਾਲ ਭੰਗੜਾ ਪਾਉਂਦੇ ਹਨ ਭੰਗੜਾ ਵੇਖ ਕੇ ਲੋਕਾਂ ਦੀਆਂ ਨਜ਼ਰਾਂ ਚੱਕੀਆਂ ਜਾਂਦੀਆਂ ਹਨ ਅਤੇ ਲੋਕ ਬਦੋ ਬਦੀ ਹੀ ਲੋਕਾਂ ਤੋਂ ਨੋਟ ਵਾਰਨੇ ਸ਼ੁਰੂ ਕਰ ਦਿੰਦੇ ਨੇ ਭੰਗੜਾ ਪੰਜਾਬੀਆਂ ਦਾ ਬਹੁਤ ਹੀ ਮਸ਼ਹੂਰ ਲੋਕ ਨਾਚ ਹੈ ਅਤੇ ਇਹ ਇਸਦੇ ਆਮ ਸਟੈਪ ਨੇ ਜਦੋਂ ਭੰਗੜਾ ਪੈਂਦਾ ਕੋਈ ਵੀ ਪ੍ਰੋਗਰਾਮ ਖੁਸ਼ੀ ਦਾ ਹੁੰਦਾ ਹੈ ਤਾਂ ਭੰਗੜਾ ਤਾਂ ਢੋਲ ਦੇ ਬਿਨਾਂ ਉਹ ਬਿਲਕੁਲ ਅਧੂਰਾ ਹੈ ਢੋਲ ਦਾ ਡਗਾ ਲੱਗਦਾ ਨਾਲ ਹੀ ਪੰਜਾਬੀ ਨੱਚਣ ਲਈ ਮਜ਼ਬੂਰ ਹੋ ਜਾਂਦੇ ਨੇ ਝੂੰਮਰ ਚੱਕਰੀ ਧਮਾਲ ਜੁਗਨੀ ਇਹ ਪੰਜਾਬੀਆਂ ਦੇ ਲੋਕ ਨਾਚ ਭੰਗੜੇ ਦੇ ਆਮ ਜਿਹੇ ਸਟੈਪ ਨੇ ਜੋ ਕਿ ਲਗਭਗ ਹਰ ਪੰਜਾਬੀ ਕਰਨਾ ਜਾਣਦਾ ਹੈ ਧੰਨਵਾਦ